ਹਾਂ ਮੈਂ ਡਾਂਸ ਰੀਲਾਂ ਸ਼ੋਟਸ ਦੇਖਦੀ ਹਾਂ ਕਿਉਂਕਿ ਇਸ ਨਾਲ ਆਨੰਦ ਮਿਲਦਾ ਹੈ ਆਪਣੇ ਵਿਹਲੇ ਸਮੇਂ ਵਿੱਚ ਆਪਣੇ ਬਿਜ਼ੀ ਜ਼ਿੰਦਗੀ ਰੁਝਾਨ ਭਰੀ ਜ਼ਿੰਦਗੀ ਦੇ ਵਿੱਚੋਂ ਮੈਂ ਥੋੜ੍ਹਾ ਸਮਾਂ ਆਨੰਦ ਲੈਣ ਲਈ ਸ਼ੋਰਟਸ ਜਾਂ ਰੀਲਾਂ ਦੇਖਦੀ ਹਾਂ ਕਿਉਂਕਿ ਇਹ ਮਨੋਰੰਜਨ ਦਾ ਸਾਧਨ ਹਨ ਇਹਨਾਂ ਰੀਲਾਂ ਦਾ ਮਕਸਦ ਇੱਕ ਮਨੋਰੰਜਕ ਜਾਂ ਫਿਰ ਇੱਕ ਦਿਲਚਸਪੀ ਜਾਂ ਇੱਕ ਰੁਚੀ ਪੈਦਾ ਕਰਨਾ ਹੁੰਦਾ ਹੈ ਮੈਂ ਵੀ ਆਪਣੇ ਮੁਰਝੇਵੇਂ ਭਰੀ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਇਹ ਰੀਲਾਂ ਜਾਂ ਸ਼ੋਟਸ ਦੇਖਦੀ ਹਾਂ ਅਤੇ ਮੇਰਾ ਮਨਪਸੰਦ ਦਾ ਡਾਂਸਰ ਮਾਈਕਲ ਜੈਕਸ਼ਨ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਡਾਂਸਰ ਹਨ ਜੋ ਮੈਨੂੰ ਪਸੰਦ ਹਨ ਪਰ ਮਾਈਕਲ ਜੈਕਸ਼ਨ ਮੇਰਾ ਫੇਵਰੇਟ ਡਾਂਸਰ ਹੈ ਅਤੇ ਮੇਰਾ ਇਹ ਹੀ ਕਹਿਣਾ ਹੈ ਕਿ ਹਰ ਇੱਕ ਦੇ ਵਿੱਚ ਇੱਕ ਕਲਾ ਹੁੰਦੀ ਹੈ ਹਰ ਇੱਕ ਇਨਸਾਨ ਦੇ ਵਿੱਚ ਗੁਣ ਹੁੰਦਾ ਹੈ ਹਰ ਇੱਕ ਇਨਸਾਨ ਨੂੰ ਕੋਈ ਕਲਾਕਾਰ ਹੁੰਦਾ ਕੋਈ ਸਿੰਗਰ ਹੁੰਦਾ ਕੋਈ ਡਾਂਸਰ ਹੁੰਦਾ ਹੈ ਮਤਲਬ ਹਰ ਇੱਕ ਦੇ ਵਿੱਚ ਜਿਹੜੀ ਵੀ ਕਰੀਏਟੀਵਿਟੀ ਹੁੰਦੀ ਹੈ ਰੁਝਾਨ ਹੁੰਦਾ ਰੁਚੀ ਹੁੰਦੀ ਹੈਗੀ ਇਨਸਾਨ ਉਹ ਚੀਜ਼ ਨੂੰ ਲੈ ਕੇ ਅੱਗੇ ਚੱਲਦਾ ਹੈ ਅਤੇ ਇਹ ਰੁਚੀਆਂ ਹੀ ਇਨਸਾਨ ਨੂੰ ਅੱਗੇ ਵਧਣ ਦੇ ਵਿੱਚ ਉਸ ਦਾ ਹੌਂਸਲਾ ਅਫਜਾਈ ਕਰਨ ਦੇ ਵਿੱਚ ਉਸਦੀ ਹਮੇਸ਼ਾ ਹੈਲਪ ਕਰਦੀਆਂ ਨੇ ਭਾਵ ਮੇਰੇ ਕਹਿਣ ਦਾ ਭਾਵ ਇਹ ਹੀ ਹੈ ਕਿ ਇਹਨਾਂ ਚੀਜ਼ਾਂ ਦਾ ਸਾਨੂੰ ਬਹੁਤ ਫਾਇਦਾ ਹੈ ਸਾਡੇ ਰੁਝਾਵੇਂ ਭਰੀ ਜ਼ਿੰਦਗੀ ਆ ਅਸੀਂ ਦਿਨ ਰਾਤ ਕੰਮ ਕਰਦੇ ਹਾਂ ਅਸੀਂ ਨੌ ਜਾਂ ਦਸ ਘੰਟੇ ਜਾਂ ਫਿਰ ਗਿਆਰਾਂ ਘੰਟੇ ਅਸੀਂ ਕੰਮ ਕਰਦੇ ਹਾਂ ਅਤੇ ਉਸ ਕੰਮ ਵ ਕੰਮ ਦੇ ਸਮੇਂ 'ਚ ਅਸੀਂ ਮਨੋਰੰਜਨ ਨਹੀਂ ਕਰ ਪਾਉਂਦੇ ਅਤੇ ਜਦੋਂ ਅਸੀਂ ਗਿਆਰ੍ਹਾਂ ਬਾਰ੍ਹਾਂ ਘੰਟੇ ਬਾਅਦ ਅਸੀਂ ਕੰਮ ਤੋਂ ਵਾਪਿਸ ਆਉਂਦੇ ਹਾਂ ਤਾਂ ਅਸੀਂ ਥੋੜ੍ਹਾ ਸਮਾਂ ਫੋਨ ਦੇਖਦੇ ਹਾਂ ਰੀਲਾਂ ਦੇਖਦੇ ਹਾਂ ਜਾਂ ਸ਼ੋਰਟਸ ਦੇਖਦੇ ਹਾਂ ਇਸ ਦਾ ਮਕਸਦ ਇਹ ਹੀ ਹੁੰਦਾ ਹੈ ਕਿ ਅਸੀਂ ਆਪਣੇ ਦਿਮਾਗ ਨੂੰ ਰਿਲੈਕਸ ਕਰਨਾ ਹੈ ਆਪਣੇ ਦਿਮਾਗ ਨੂੰ ਥੋੜ੍ਹਾ ਤਾਜ਼ਗੀ ਦੇਣੀ ਹੈ ਥੋੜ੍ਹਾ ਜਿਹਾ ਆਨੰਦ ਦੇਣਾ ਹੈ ਇਸਦਾ ਮਕਸਦ ਇਹ ਹੁੰਦਾ ਹੈ ਇਸ ਲਈ ਮੇਰਾ ਤਾਂ ਡਾਂਸ ਰੀਲਾਂ ਸ਼ੋਟਸ ਦੇਖਣ ਦਾ ਇਹ ਹੀ ਮਕਸਦ ਹੁੰਦਾ ਹੈ ਮੇਰਾ ਫੇਵਰਿਟ ਤੁਹਾਨੂੰ ਮੈਂ ਦੱਸਿਆ ਕਿ ਮੇਰਾ ਫੇਵਰੇਟ ਡਾਂਸਰ ਮਾਈਕਲ ਜੈਕਸ਼ਨ ਹੈ